ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਇਹ ਲਾਇਬ੍ਰੇਰੀ ਆਈ ਆਈ ਟੀ ਰੋਪੜ ਦੇ ਵਿੱਚ ਹੈ ਅਤੇ ਇਹ ਸਾਡਾ ਜਿਹੜਾ ਵਿਸ਼ ਐੱਮ ਵਿਸ਼ਵਰਿਆ ਬਲਾਕ ਹੈ ਉਹਦੇ ਐਨ ਬਿਲਕੁਲ ਬੈਕ ਸਾਈਡ 'ਤੇ ਸਾਡੀ ਲਾਇਬ੍ਰੇਰੀ ਹੈ ਸਰ ਸਾਡੀ ਟਾਈਮਿੰਗ ਹੈਗੀ ਹੈ ਜੀ ਨੌਂ ਵਜੋ ਤੋਂ ਲੈ ਕੇ ਸ਼ਾਮ ਦੇ ਸੱਤ ਵਜੇ ਤੱਕ ਤੁਸੀਂ ਇੱਥੇ ਸਾਡੇ ਕੋਲ ਸਰ ਪੰਜਾਬੀ ਅੰਗਰੇਜ਼ੀ ਅਤੇ ਬਾਕੀ ਜਿਹੜੇ ਬਹੁਤ ਫੇਮਸ ਸਾਡੇ ਕੋਲ ਜਿਹੜੇ ਰਾਈਟਰ ਨੇ ਅੰਮ ਜਿੱਦਾਂ ਹੋ ਗਿਆ ਅੰਮ੍ਰਿਤਾ ਪ੍ਰੀਤਮ ਹੋ ਗਏ ਸੁਰਜੀਤ ਪਾਤਰ ਜੀ ਰਘੂਬੀਰ ਨਾਨਕ ਸਿੰਘ ਅਤੇ ਬਾਬਾ ਬੁੱਲ੍ਹੇ ਸ਼ਾਹ ਇਨ੍ਹਾਂ ਦੀਆਂ ਜਿਹੜੀਆਂ ਵੀ ਕਿਤਾਬਾਂ ਨੇ ਉਹ ਸਾਡੇ ਕੋਲ ਸਾਰੀਆਂ ਅਵੇਲੇਬਲ ਨੇ ਪਨ ਇਨ੍ਹਾਂ ਦੀਆਂ ਪੰਜਾਬੀ ਲਿਟਰੇਚਰ ਪੋਏਟਰੀ ਨਾਵਲ ਸਟੋਰੀ ਇਨ੍ਹਾਂ ਦੀਆਂ ਬਾਇਓਗ੍ਰਾਫੀ ਸਾਡੇ ਕੋਲ ਸਾਰੀਆਂ ਅਵੇਲੇਬਲ ਨੇ ਸਰ ਸਰ ਤੁਹਾਨੂੰ ਸਭ ਤੋਂ ਪਹਿਲਾਂ ਲਾਇਬ੍ਰੇਰੀ ਦੇ ਵਿੱਚ ਆਉਣਾ ਪਵੇਗਾ ਉੱਥੇ ਆ ਕੇ ਤੁਹਾਨੂੰ ਆਪਣਾ ਕਾਰਡ ਬਣਵਾਉਣਾ ਪਵੇਗਾ ਕਾਰਡ ਦੇ ਨਾਲ ਸਰ ਤੁਹਾਨੂੰ ਕੋਈ ਨਾ ਆਪਣਾ ਜੋ ਵੀ ਤੁਹਾਡਾ ਕੋਈ ਰਿਕਾਰਡ ਹੈਗਾ ਆਧਾਰ ਕਾਰਡ ਵਗੈਰਾ ਉਹ ਸਾਨੂੰ ਦੇਣਾ ਪਵੇਗਾ ਅਤੇ ਹੈਂ ਜੀ ਫੋਟੋ ਵੀ ਹਾਂਜੀ ਫੋਟੋ ਵੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਤੁਸੀਂ ਸਾਨੂੰ ਦੇ ਕੇ ਤੁਸੀਂ ਲਾਇਬ੍ਰੇਰੀ ਦੇ ਵਿੱਚ ਕਾਰਡ ਬਣਵਾ ਸਕਦੇ ਹੋ ਅਤੇ ਕਾਰਡ ਦਾ ਸਰ ਜਿਹੜਾ ਫਾਇਦਾ ਇਹ ਆ ਕਿ ਤੁਸੀਂ ਆਪਣੀਆਂ ਜਿਹੜੀਆਂ ਕਿਤਾਬਾਂ ਨੇ ਉਹ ਆਪਣੇ ਨਾਮ 'ਤੇ ਲੈ ਸਕਦੇ ਹੋ ਜੇ ਤੁਸੀਂ ਕਾਰਡ ਲਾਇਬ੍ਰੇਰੀ ਤੋਂ ਕੋਈ ਕਿਤਾਬ ਲੈਣਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਜਿੰਨਾ ਟਾਈਮ ਹੈਗਾ ਦੋ ਮਹੀਨੇ ਤਿੰਨ ਮਹੀਨੇ ਦੇ ਲਈ ਤੁਸੀਂ ਉਹ ਕਾਰਡ ਦੇ ਥਰੂ ਆਪਣੀਆਂ ਕਿਤਾਬਾਂ ਈਸ਼ੂ ਕਰਵਾ ਸਕਦੇ ਨੇ ਆਪਣੇ ਨਾਮ 'ਤੇ ਉਸ ਟਾਈਮ ਦੇ ਵਿੱਚ ਹਾਂਜੀ ਸਰ ਜੇ ਤੁਸੀਂ ਉਸ ਟਾਈਮ ਦੇ ਵਿੱਚ ਤੁਹਾਨੂੰ ਮੰਨ ਲਓ ਤੁਹਾਨੂੰ ਇੱਕ ਕਿਤਾਬ ਅਸੀਂ ਅਤੇ ਦੋ ਮਹੀਨੇ ਲਈ ਈਸ਼ੂ ਈਸ਼ੂ ਕੀਤੀ ਹੈ ਅਗਰ ਤਾਂ ਇੱਕ ਦੋ ਦਿਨ ਉੱਪਰ ਹੋ ਜਾਂਦੇ ਹੈ ਫਿਰ ਤਾਂ ਸਰ ਕੋਈ ਗੱਲ ਨਹੀਂ ਹੈਗੀ ਬਟ ਉਸ ਪੰਦਰਾ ਦਿਨ ਵੀਹ ਦਿਨ ਦੇ ਵਿੱਚ ਤੁਹਾਨੂੰ ਪਰ ਡੇਅ ਦੇ ਹਿਸਾਬ ਦੇ ਨਾਲ ਫਾਈਨ ਪੈਣਾ ਸ਼ੁਰੂ ਹੋ ਜਾਂਦਾ ਹਾਂਜੀ ਸਰ ਆਨਲਾਈਨ ਬੁੱਕਸ ਵੀ ਮਿਲ ਜਾਣਗੀਆਂ ਤੁਹਾਨੂੰ ਆਨਲਾਈਨ ਦੇ ਵਿੱਚ ਵੀ ਤੁਸੀਂ ਜਿਹੜੇ ਮੈਂ ਤੁਹਾਨੂੰ ਪਾਤਰ ਦੱਸੇ ਹੈ ਉਨ੍ਹਾਂ ਦੀਆਂ ਅਸੀਂ ਤੁਹਾਨੂੰ ਪੀ ਡੀ ਐੱਫ ਵੀ ਪੀ ਡੀ ਐੱਫ ਦੇ ਸਕਦੇ ਹਾਂ ਅਤੇ ਇਹ ਇਹ ਇਨ੍ਹਾਂ ਦੀਆਂ ਜੇ ਜੋ ਵੀ ਇਨ੍ਹਾਂ ਦੇ ਲਿਟਰੇਚਰ ਨੇ ਨਾਵਲ ਇਹ ਸਟੋਰੀਆਂ ਇਹ ਸਾਰੀਆਂ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਸਕਦੇ ਹਾਂ ਜੀ ਉਪਲਬਧ ਕਰਵਾ ਸਕਦੇ ਹਾਂ ਅਤੇ ਨਾਲ ਤੁਹਾਨੂੰ ਇਲੈਕਟ੍ਰਾਨਿਕ ਬੁੱਕਸ ਵੀ ਹਾਂਜੀ ਹਾਂਜੀ ਇੱਕ ਪਾਸੇ ਜਿਹੜੇ ਸਕੂਲ ਦੇ ਵਿਦਿਆਰਥੀ ਨੇ ਉਨ੍ਹਾਂ ਦੇ ਲਈ ਅਸੀਂ ਅਲੱਗ ਤੋਂ ਸੈਕਸ਼ਨ ਬਣਾਏ ਹੋਏ ਨੇ ਅਲੱਗ ਸਾਡੇ ਕੋਲ ਸੈਕਸ਼ਨ ਬਣੇ ਹੋਏ ਨੇ ਜਿਹੜੇ ਸਾਡੇ ਕੋਲ ਦੂਜੇ ਪੜ੍ਹਨ ਦੇ ਲਈ ਪ੍ਰੋਫੈਸਰਜ਼ ਆਉਂਦੇ ਨੇ ਜਾਂ ਕੋਈ ਹੋਰ ਵੱਡੇ ਸਾਡੇ ਕੋਲ ਉਮਰ ਦੇ ਆਉਂਦੇ ਨੇ ਤਾਂ ਉਨ੍ਹਾਂ ਲਈ ਅਸੀਂ ਅਲੱਗ ਤੋਂ ਬਣਾਏ ਹੋਏ ਨੇ ਹਾਂਜੀ